ਮੈਂ ਅਤੇ ਮੇਰੇ ਦੋਸਤਾਂ ਨੇ ਕਈ ਜਗ੍ਹਾ 'ਤੇ ਘੁੰਮਿਆ ਹੈ ਅਤੇ ਉਹਨਾਂ ਵਿੱਚੋਂ ਸਾਡਾ ਇੱਕ ਜਗ੍ਹਾ ਬਹੁਤ ਯਾਦਗਾਰ ਰਿਹਾ ਅਸੀਂ ਸ਼ਿਮਲੇ ਗਏ ਸੀ ਅਸੀਂ ਪੰਜ ਦੋਸਤ ਸੀ ਅਤੇ ਸਾਡੇ ਕੋਲ ਆਪਣੀ ਆਪਣੀ ਬਾਈਕ ਸੀਗੀ ਅਤੇ ਅਸੀਂ ਉੱਥੇ ਜਾ ਕੇ ਬਹੁਤ ਇੰਜੋਏ ਕੀਤਾ ਅਸੀਂ ਆਪਣਾ ਸਾਰਾ ਸਮਾਨ ਨਾਲ ਲੈ ਕੇ ਗਏ ਸੀ ਆਪਣਾ ਖਾਣ ਪੀਣ ਦਾ ਸਾਡੇ ਨਾਲ ਸਮਾਨ ਸਾਨੂੰ ਘਰਦਿਆਂ ਨੇ ਬਣਾ ਕੇ ਦਿੱਤਾ ਸੀਗਾ ਜਿਨ੍ਹਾਂ ਵਿੱਚ ਨਮਕੀਨ ਬਿਸਕੁਟ ਸਮੋਸੇ ਹੋਰ ਵੀ ਬਹੁਤ ਕੁਝ ਸੀਗੀਆਂ ਅਤੇ ਅਸੀਂ ਆਪਣਾ ਆਪਣੇ ਆਪ ਨੂੰ ਗਰਮ ਰੱਖਣ ਲਈ ਗਰਮ ਚੀਜ਼ਾਂ ਵੀ ਲੈ ਕੇ ਗਏ ਸੀ ਸਾਡੇ ਕੋਫੀ ਦੇ ਕੱਪ ਅਤੇ ਬੋਤਲ ਵਿੱਚ ਗਰਮ ਪਾਣੀ ਹੋਰ ਗਰਮ ਕੋਫੀ ਗਰਮ ਚਾਹ ਸਭ ਕੁਛ ਸਾਡੇ ਨਾਲ ਲੈ ਕੇ ਗਏ ਸੀ ਅਸੀਂ ਅਤੇ ਅਸੀਂ ਆਪਣਾ ਤੰਬੂ ਵੀ ਕੈਂਪ ਵੀ ਘਰੋਂ ਲੈ ਕੇ ਗਏ ਸੀ ਅਸੀਂ ਆਪਣਾ ਸਮਾਨ ਸਾਰਾ ਲੈ ਕੇ ਗਏ ਸੀਗੇ ਉੱਥੇ ਸਾਨੂੰ ਕਿਸੇ ਬਾਹਰ ਦੇ ਚੀਜ਼ ਦੀ ਲੋੜ ਨਹੀਂ ਪਈ ਅਸੀਂ ਸਾਰੇ ਦੋਸਤ ਰਹਿੰਦੇ ਸੀ ਇਕੱਠੇ ਅਤੇ ਰਸਤੇ ਵਿੱਚ ਅਸੀਂ ਬਹੁਤ ਇੰਜੋਏ ਕੀਤਾ ਰਸਤੇ ਵਿੱਚ ਲੰਗਰ ਲੱਗਿਆ ਸੀ ਇੱਕ ਜਗ੍ਹਾ 'ਤੇ ਉਹ ਅਸੀਂ ਖਾਧਾ ਪੀਤਾ ਖਾ ਪੀ ਕੇ ਫਿਰ ਅੱਗੇ ਨੂੰ ਨਿਕਲ ਲਏ ਫਿਰ ਅਸੀਂ ਇੱਕ ਜਗ੍ਹਾ 'ਤੇ ਰੁਕ ਕੇ ਬਹੁਤ ਇੰਜੋਏ ਕੀਤਾ